ਹਾਂਜੀ ਮੈਂ ਰਾਜ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਹੋਣ ਵਾਲੇ ਹਰ ਮੁਕਾਬਲੇ ਦੇ ਵਿੱਚ ਭਾਗ ਲੈਂਦੀ ਹਾਂ ਤਾਂ ਕਿ ਮੇਰਾ ਤਾਂ ਕਿ ਮੇਰਾ ਜੋ ਹੁਨਰ ਹੈ ਜੋ ਪੇਂਟਿੰਗ ਦਾ ਹੁਨਰ ਹੈ ਉਸਨੂੰ ਅੱਗੇ ਲਿਆ ਸਕਾਂ ਮੈਂ ਉੱਥੇ ਆਪਣੀ ਪੇਂਟਿੰਗ ਦਿਖਾਉਂਦੀ ਹਾਂ ਅਤੇ ਮੈਨੂੰ ਉੱਥੇ ਹੋਰ ਵੀ ਲੋਕਾਂ ਦੀਆਂ ਬਹੁਤ ਸਾਰੀਆਂ ਪੇਂਟਿੰਗਾਂ ਡਰਾਇੰਗ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ ਜਿਸ ਨਾਲ ਜਿਸ ਨੂੰ ਦੇਖਣ ਨਾਲ ਮੇਰਾ ਤਜਰਬਾ ਹੋਰ ਵੀ ਵੱਧਦਾ ਹੈ ਅਤੇ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਅੱਗੇ ਤੋਂ ਮੈਂ ਇਹਦੇ ਵਿੱਚ ਕੁਛ ਹੋਰ ਵੀ ਜੋੜ ਸਕਦੀ ਹਾਂ ਜਿਸ ਨਾਲ ਮੇਰੀ ਪੇਂਟਿੰਗ ਨੂੰ ਹੋਰ ਵੀ ਵਧੀਆ ਬਣਾਇਆ ਜਾ ਸਕੇ ਅਜਿਹਾ ਕਰਨ ਨਾਲ ਮੇਰਾ ਤਜਰਬਾ ਹੋਰ ਵੀ ਵਧ ਜਾਂਦਾ ਹੈ ਅਤੇ ਮੈਂ ਇਹ ਮਹਿਸੂਸ ਕਰਦੀ ਹਾਂ ਕਿ ਮੈਂ ਅੱਗੇ ਤੋਂ ਹੋਰ ਵੀ ਜ਼ਿਆਦਾ ਵਧੀਆ ਕੰਮ ਕਰਕੇ ਹੋਰ ਵੀ ਜ਼ਿਆਦਾ ਇਨਾਮ ਜਿੱਤ ਸਕਾਂ ਤਾਂ ਕਿ ਮੈਨੂੰ ਹੋਰ ਵੀ ਮਾਣ ਮਹਿਸੂਸ ਹੋ ਸਕੇ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕੁਛ ਕੀਤਾ ਹੈ